ਅੱਜ ਕੱਲ੍ਹ ਦੇ ਮੌਸਮ ਨੂੰ ਦੇਖ ਕੇ ਜਾਨਵਰਾਂ ਨੂੰ ਚਰਾਉਣ ਲਈ ਜ ਸਥਾਨ ਨੇ ਜਿਹੜੇ ਜਾਨਵਰਾਂ ਦੇ ਚਰਨ ਵਾਲੀਆਂ ਜਗ੍ਹਾ ਨੇ ਬਹੁਤ ਸਾਰੀਆਂ ਘੱਟ ਗਈਆਂ ਹਨ ਕਿਉਂਕਿ ਜਿਹੜੇ ਪਹਿਲਾਂ ਖਾਲੀ ਜਗ੍ਹਾ ਪਈ ਹੁੰਦੀ ਸੀ ਲੋਕਾਂ ਨੇ ਉਹਨਾਂ ਨੂੰ ਵਾਹ ਕੇ ਆਪਣੀ ਫਸਲ ਵਾਸਤੇ ਵਰਤਣ ਲੱਗ ਪਏ ਹਨ ਅਤੇ ਲੋਕ ਪੇੜ ਪੌਦੇ ਵੀ ਘੱਟ ਲਾਉਂਦੇ ਹਨ ਪਹਿਲਾਂ ਕੀ ਹੁੰਦਾ ਸੀ ਪੇੜ ਪੌਦੇ ਵੱਧ ਹੁੰਦੇ ਸੀ ਪੇੜ ਪੌਦਿਆਂ ਦੇ ਵਿੱਚ ਹੀ ਬਹੁਤ ਸਾਰਾ ਘਾਹ ਫੂਸ ਉੱਗ ਆਉਂਦਾ ਸੀ ਜਿੱਥੇ ਕਿ ਜਾਨਵਰ ਗਾਵਾਂ ਮੱਝਾਂ ਜਾ ਕੇ ਚਰ ਆਉਂਦੀਆਂ ਸੀ ਅਤੇ ਹੁਣ ਜ ਫਸਲਾਂ ਦੇ ਵਿੱਚ ਜ਼ਿਆਦਾਤਰ ਰੇਹ ਸਪਰੇਆਂ ਕਰਕੇ ਜਿਹੜਾ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਜ਼ਿਆਦਾਤਰ ਪਲਾਸਟਿਕ ਦੀ ਵਰਤੋਂ ਹੋ ਰਹੀ ਹੈ ਪਾਣੀ ਦੀ ਕਮੀ ਹੋਣ ਕਰਕੇ ਜਿਹੜੀਆਂ ਗਊਆਂ ਨੇ ਮੱਝਾਂ ਨੇ ਇਹਨਾਂ ਨੂੰ ਚਰਨ ਲਈ ਜਗ੍ਹਾ ਕਿਤੇ ਵੀ ਨਹੀਂ ਬਚੀ ਹੈ ਗਊਆਂ ਜਿਹੜੀਆਂ ਜਿਹਨਾਂ ਨੂੰ ਅਸੀਂ ਗਊ ਮਾਤਾ ਕਹਿੰਦੇ ਹਾਂ ਹੈ ਨਾ ਜਿਹਨਾਂ ਨੂੰ ਗਊ ਮਾਤਾ ਸਮਝ ਕੇ ਦੁੱਧ ਵੀ ਇਹਨਾਂ ਤੋਂ ਲੈਂਦੇ ਹਾਂ ਜ਼ਿਆਦਾਤਰ ਲੋਕ ਉਹਨਾਂ ਨੂੰ ਹੀ ਹਰਾ ਚਾਰਾ ਪਾਉਂਦੇ ਹਨ ਜਿਹੜੀਆਂ ਗਊਆਂ ਤੋਂ ਦੁੱਧ ਲਿਆ ਜਾਂਦਾ ਜਿਹੜੀਆਂ ਗਊਆਂ ਵੈਸੇ ਹੀ ਅਵਾਰਾ ਫਿਰਦੀਆਂ ਨੇ ਉਹ ਵਿਚਾਰੀਆਂ ਕੀ ਕਰਦੀਆਂ ਨੇ ਪਲਾਸਟਿਕ ਖਾਂਦੀਆਂ ਨੇ ਪਾਣੀ ਗੰਦਾ ਜਿੱਥੇ ਖੜ੍ਹਾ ਹੁੰਦਾ ਉਹ ਪੀਂਦੀਆਂ ਨੇ ਜਿਹਨਾਂ ਜਿਹੜਾ ਉਹਨਾਂ ਦੀ ਸਿਹਤ 'ਤੇ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪਾ ਰਿਹਾ ਹੈਗਾ ਇਹ ਇਹ ਸਾਡੀਆਂ ਗਾਵਾਂ ਨੂੰ ਬਹੁਤ ਨੁਕਸਾਨ ਪਹੁੰਚਾ ਰਿਹਾ ਸਾਡੇ ਜਿਵੇਂ ਜਾਨਵਰ ਹੋ ਗਏ ਕੁੱਤੇ ਹੋ ਗਏ ਕੁੱਤੇ ਹੋ ਗਏ ਹੈ ਨਾ ਇਹਨਾਂ ਨੂੰ ਵੀ ਇਹਨਾਂ ਦੀ ਸਿਹਤ ਲਈ ਵੀ ਜਿਹੜਾ ਮੌਸਮ ਹੈ ਬਹੁਤ ਜ਼ਿਆਦਾ ਵਧੀਆ ਨਹੀਂ ਹੈ ਅਤੇ ਕਿਉਂਕਿ ਜ਼ਿਆਦਾ ਪਲਾਸਟਿਕ ਦੀ ਵਰਤੋਂ ਹੋ ਗਈ ਮੌਸਮ ਨਹੀਂ ਵਧੀਆ ਹੈਗਾ ਏਸੀਆਂ ਦੀ ਵਰਤੋਂ ਹੋਣ ਕਰਕੇ ਰੇਹਾਂ ਸਪਰੇਆਂ ਦੀ ਵਰਤੋਂ ਹੋਣ ਕਰਕੇ ਲੋਕਾਂ ਦਾ ਰੁਝਾਨ ਹੈ ਜਿਹੜਾ ਜ਼ਿਆਦਾਤਰ ਆਪਣੀਆਂ ਫਸਲਾਂ ਤੱਕ ਹੀ ਰਹਿ ਗਿਆ ਜੰਗਲ ਲਾਉਣਾ ਪੇੜ ਪੌਦੇ ਦਰਖਤਾਂ ਅਤੇ ਸੜਕਾਂ ਦੇ ਕਿਨਾਰੇ ਲਾਉਣੇ ਇਹਨਾਂ ਦਾ ਰੁਝਾਨ ਬਹੁਤ ਜ਼ਿਆਦਾ ਘੱਟ ਗਿਆ ਜਿਹਦੇ ਕਰਕੇ ਆਮ ਜਨਜੀਵਨ 'ਤੇ ਵੀ ਪ੍ਰਭਾਵ ਪਿਆ ਜਾਨਵਰਾਂ ਦੀਆਂ ਸਿਹਤਾਂ 'ਤੇ ਵੀ ਬਹੁਤ ਸਾਰੇ ਜਾਨਵਰ ਨੇ ਜਿਹੜੇ ਜੰਗਲਾਂ ਵਿੱਚ ਰਹਿੰਦੇ ਉਹ ਇਹਨਾਂ ਕਾਰਨਾਂ ਕਰਕੇ ਹੀ ਖਤਮ ਹੋ ਰਹੇ